ਤੁਹਾਡੇ ਖੇਤਰ ਵਿੱਚ ਲੋਕ ਕਿਹੜੇ ਪ੍ਰਮੁੱਖ ਟੈਲੀਫੋਨ ਵਰਤਦੇ ਹਨ ਜੀ ਸਾਡੇ ਖੇਤਰ ਵਿੱਚ ਅੱਜ ਕੱਲ੍ਹ ਨਿਆਣੇ ਤੋਂ ਲੈ ਕੇ ਸਿਆਣੇ ਤੱਕ ਸਾਰੇ ਸਮਾਰਟਫੋਨ ਵਰਤ ਰਹੇ ਹਨ ਇਹਨਾਂ ਵਿੱਚ ਵੱਖ ਵੱਖ ਸੂਚੀ ਜਿਵੇਂ ਕਿ ਐਂਡਰੋਇਡ ਫੋਨ ਜ਼ਿਆਦਾਤਰ ਵਰਤ ਰਹੇ ਹਨ ਜਿਵੇਂ ਕਿ ਆਪਣਾ ਓਪੋ ਬੀਵੋ ਰੈਡਮੀ ਇੰਟੈਕਸ ਸੈਮਸੰਗ ਜ਼ਿਆਦਾ ਤੌਰ 'ਤੇ ਵਰਤੋਂ ਵਿੱਚ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਐਪਲ ਦੇ ਫੋਨ ਵੀ ਵਰਤੋਂ ਵਿੱਚ ਬਹੁਤ ਜ਼ਿਆਦਾ ਵਰਤ ਰਹੇ ਹਨ ਇਹਨਾਂ ਸਾਡੇ ਮੇਰੇ ਕੋਲ ਜੀ ਓਪੋ ਏ ਪੰਦਰ੍ਹਾਂ ਫੋਨ ਹੈ ਅਤੇ ਇਹਨਾਂ ਵਿੱਚ ਵਿਸ਼ੇਸ਼ਤਾਵਾਂ ਬਹੁਤ ਹਨ ਜਿਵੇਂ ਕਿ ਬਹੁਤ ਦੂਰ ਰਹਿੰਦੇ ਜਿਵੇਂ ਵਿਦੇਸ਼ਾਂ ਵਿੱਚ ਨਿਆਣੇ ਪੜ੍ਹ ਰਹੇ ਹਨ ਉਹ ਆਪਣੇ ਸਿਆਣੇ ਮਾਂ ਪਿਓ ਨਾਲ ਗੱਲਾਂ ਕਰ ਰਹੇ ਹਨ ਇਹਨਾਂ ਫੋਨਾਂ ਵਿੱਚ ਮਤਲਬ ਕਿ ਵੀਡੀਓ ਕੌਲ ਦੀ ਫੈਸਿਲਿਟੀ ਆਡੀਓ ਟੇਕ ਵਟਸਐਪ ਆਦਿ ਹੋਰ ਤਰ੍ਹਾਂ ਤਰ੍ਹਾਂ ਦੇ ਐਪ ਹਨ ਜਿਹਨਾਂ ਨਾਲ ਮਤਲਬ ਕਿ ਸਾਰੇ ਆਪਣੇ ਸਿਆਣੇ ਨੌਜਵਾਨ ਸੰਤੁਸ਼ਟ ਹਨ ਅੱਜ ਕੱਲ੍ਹ ਜਿਹਦੇ ਵੀ ਫੋਨ ਹੱਥ 'ਚ ਦੇਖੀ ਜਾਵੇ ਜਾਂ ਜੇਬ 'ਚ ਮਤਲਬ ਕਿ ਜੋ ਵੀ ਕੋਈ ਵੀ ਵਿਅਕਤੀ ਹੈ ਉਸ ਕੋਲ ਅੱਜ ਦੇ ਟਾਈਮ ਵਿੱਚ ਇੱਕ ਜਾਂ ਦੋ ਸਮਾਰਟਫੋਨ ਜ਼ਰੂਰ ਹਨ ਇੱਕ ਤਾਂ ਹਰ ਇੱਕ ਕੋਲ ਹੀ ਹੈ ਅਤੇ ਦੂਜਾ ਇਸ ਲਈ ਫੋਨ ਸਾਰਿਆਂ ਦੇ ਇੱਕ ਸਰੀਰ ਦਾ ਅੰਗ ਬਣ ਚੁੱਕਾ ਹੈ ਅਤੇ ਇਸ ਵਿੱਚ ਬਹੁਤ ਸਾਰੇ ਜਿੱਦਾਂ ਨੋਲਜ ਅੱਜ ਕੱਲ੍ਹ ਦੇ ਵਿਦਿਆਰਥੀ ਜ਼ਿਆਦਾ ਤੌਰ 'ਤੇ ਆਪਣਾ ਓਨਲਾਈਨ ਸਟੱਡੀ ਇਹਨਾਂ ਫੋਨਾਂ ਰਾਹੀਂ ਪੂਰੀ ਕਰ ਰਹੇ ਹਨ